ਹਾਂਜੀ ਹੈਲ ਹਾਂਜੀ ਵੀਰ ਜੀ ਬੜੀ ਔਖੀ ਜੀ ਬੜੀ ਔਖਾ ਤੁਹਾਡਾ ਨੰਬਰ ਲੱਭਿਆ ਤੇ ਰਾਮ ਰਾਮ ਜੀ ਅੱਛਾ ਤੁਸੀਂ ਉਹਹੀ ਤਰਖਾਣ ਹੀ ਬੋਲਦੇ ਹੋ ਨਾ ਜੀ ਉਹ ਆਪਣੇ ਲਾਭ ਕੇ ਪਿੰਡ ਵਾਲੇ ਅੱਛਾ ਜੀ ਹਾਂਜੀ ਬੜਾ ਔਖਾ ਜੀ ਤੁਹਾਨੂੰ ਲੱਭਿਆ ਬੜੀ ਸੁਣੀ ਸੀ ਮੈਂ ਤੁਹਾਡੀ ਐਕਚੁਅਲ 'ਚ ਜੀ ਅਸੀਂ ਇੱਕ ਬੈਡ ਬਣਾਉਣਾ ਸੀ ਬਣਵਾਉਣਾ ਸੀ ਮਤਲਬ ਅਤੇ ਬੈਡ ਉਹ ਹੀ ਗੱਲ ਅਸੀਂ ਘਰ ਬਣਵਾਉਣਾ ਹੈ ਆਪ ਅਤੇ ਆਪਣੇ ਬੈਡ ਬੁੱਡ ਦਾ ਜਿਵੇਂ ਕੀ ਸਿਸਟਮ ਵਗੈਰਾ ਹੈ ਵੈਸੇ ਬੈਡ ਅਸੀਂ ਜੀ ਸੋਚਿਆ ਹੋਇਆ ਤਾਂ ਮਤਲਬ ਉਹ ਆਪਣੇ ਬੈਡ ਬੋਕਸ ਨਹੀਂ ਹੁੰਦੇ ਜਿਵੇਂ ਵੱਡੇ ਵਾਲੇ ਹਾਂਜੀ ਬੋਕਸ ਵਾਲਾ ਬੈੱਡ ਬਣਵਾਉਣਾ ਅਤੇ ਤੁਸੀਂ ਜਿਵੇਂ ਜਿੰਨੀ ਚੀਜ਼ ਕਹੋਗੇ ਆਪਾਂ ਲਿਆ ਦਾਂਗੇ ਆਪਾਂ ਨੂੰ ਕੋਈ ਨਹੀਂ ਦਿੱਕਤ ਬਟ ਆਪਾਂ ਨੂੰ ਚੀਜ਼ ਵਧੀ ਵਧੀਆ ਚਾਹੀਦੀ ਹੈ ਤਾਂ ਹੀ ਹਾਂਜੀ ਉਹ ਹੀ ਤਾਂ ਮੈਂ ਬਾਜ਼ਾਰ ਦੇ ਵਿੱਚ ਵੀ ਚਾਰ ਲੋ ਹਾਂਜੀ ਅੱਛਾ ਜੀ ਤਾਂ ਹੀ ਤਾਂ ਮੈਂ ਬਾਜ਼ਾਰ ਦੇ ਵਿੱਚ ਵੀ ਚਾਰ ਲੋਕਾਂ ਨੂੰ ਪੁੱਛ ਕੇ ਕਿ ਹਾਂ ਬਈ ਕੌਣ ਚੰਗਾ ਬਣਾਵੇਗਾ ਅਤੇ ਕੌਣ ਨਹੀਂ ਮੈਂ ਤਾਂ ਹੁਣ ਤੁਹਾਡਾ ਨੰਬਰ ਮੈਂ ਲੱਭਿਆ ਅਤੇ ਮੈਂ ਕਿਹਾ ਚਲੋ ਗੱਲ ਕਰੀਏ ਤਾਂ ਆਪਾਂ ਨੂੰ ਹਾਂਜੀ ਅਤੇ ਆਪਾਂ ਨੂੰ ਉਹ ਪੂਰੀ ਬੈਕ ਸਾਈਡ ਹੈ ਨਾ ਜਿਵੇਂ ਵੱਡੀ ਵਾਲੀ ਨਹੀਂ ਹੁੰਦੀ ਡਿਜ਼ਾਇਨ ਵਾਲੀ ਜੀ ਉਹਦੇ ਵਿੱਚ ਜਿਵੇਂ ਕਾਰੀਗਿਰੀ ਕੀਤੀ ਹੁੰਦੀ ਹੈ ਲੱਕੜ ਦੇ ਵਿੱਚ ਹਾਂਜੀ ਹਾਂਜੀ ਉਹ ਡਿਜ਼ਾਇਨ ਜਿਵੇਂ ਫੁੱਲ ਪੱਤੀਆਂ ਦੀਆਂ ਕਾਰੀਗਰੀਆਂ ਕੀਤੀਆਂ ਹੁੰਦੀਆਂ ਅਤੇ ਉਸ ਤਰ੍ਹਾਂ ਦੀ ਬੈਕ ਚਾਹੀਦੀ ਹੈ ਅਤੇ ਉਹ ਆਪਾਂ ਨੂੰ ਚਾਹੀਦੇ ਬਲੈਕ ਅਤੇ ਬਰਾਉਨ ਕਲਰ ਦੇ ਵਿੱਚ ਅਤੇ ਬੈਡ ਆਪਾਂ ਨੂੰ ਚਾਹੀਦਾ ਅਤੇ ਤਿੰਨ ਤਿੰਨ ਕ ਫੁੱਟ ਮਤਲਬ ਉੱਚਾ ਤਾਂ ਹੋਵੇ ਹੀ ਬੈਡ ਹਾਂਜੀ ਹਾਂਜੀ ਉਹ ਆ ਨਾ ਮਤਲਬ ਜਿਵੇਂ ਤੁਸੀਂ ਕਹੋਗੇ ਆਪਾਂ ਉੱਦਾਂ ਦੀ ਚੀਜ਼ ਤੁਹਾਨੂੰ ਲਿਆ ਦਾਂਗੇ ਬਣਾਉਣ ਨੂੰ ਲੱਕੜ ਜਿਵੇਂ ਤੁਸੀਂ ਕਹੋਗੇ ਬਸ ਚੀਜ਼ ਵਧੀਆ ਬਣਾ ਦਿਓ ਜਾ ਜਾਂ ਤਾਂ ਫਿਰ ਇਹ ਹੈ ਨਾ ਕਿ ਚਲੋ ਆਪਾਂ ਫਿਰ ਜਦੋਂ ਉਹਦੀ ਕਰਨ ਲੱਕੜ ਜਿਵੇਂ ਲੈਣ ਜਾਣੀ ਹੈ ਕੁਝ ਵ ਵੇਖਣ ਜਾਣੀ ਹੈ ਅਤੇ ਫਿਰ ਤੁਸੀਂ ਨਾਲ ਚੱਲਦੇ ਰਿਹੋ ਆਪਾਂ ਇਕੱਠੇ ਵੇਖ ਆਵਾਂਗੇ ਫਿਰ ਉਹ ਤੁਸੀਂ ਉੱਥੇ ਉੱਥੇ ਚੀਜ਼ ਵੇਖ ਕੇ ਦੱਸ ਦਿਓ ਨਾ ਵੀ ਕਿਸਦੀ ਚੀਜ਼ ਜ਼ਿਆਦਾ ਵਧੀਆ ਬਣਨੀ ਜੇ ਹਾਂਜੀ ਅਤੇ ਉਹ ਹਾਂਜੀ ਉਹ ਬੈਡ ਬੋਕਸ ਬਣਾਉਣਾ ਅਤੇ ਨਾਲ ਉਹਦੇ ਆਪਾਂ ਨੂੰ ਪੂਰਾ ਸੈਟ ਚਾਹੀਦਾ ਜਿਵੇਂ ਸੈਟ ਉਹਦੇ ਨਾ ਜਿਵੇਂ ਅੱਗੇ ਟੇਬਲ ਹੋ ਜਾਏ ਇੱਕ ਅਤੇ ਨਾਲ ਚੇਅਰ ਹਾਂਜੀ ਹਾਂਜੀ ਹਾਂਜੀ ਨਹੀਂ ਉਸ ਤੋਂ ਇਲਾਵਾ ਜਿਵੇਂ ਮੈਂ ਕਹਿੰਦਾ ਸੀ ਨਾ ਬਈ ਨਾਲ ਉਹਦੇ ਇੱਕ ਅੱਧਾ ਹੋਰ ਜਿਵੇਂ ਛੋਟਾ ਟੇਬਲ ਜਿਵੇਂ ਕਮਰੇ ਦੇ ਵਿੱਚ ਤੁਸੀਂ ਲਾ ਲਓ ਅਤੇ ਨਾਲ ਬੈਡ ਦੇ ਮੈਂ ਹ ਹਾਂਜੀ ਅਤੇ ਨਾਲ ਹਾਂਜੀ ਅਤੇ ਕੋਈ ਦੋ ਚਾਰ ਕੁਰਸੀਆਂ ਵੀ ਨਾਲ ਮੈਂ ਕਿਹਾ ਸੇਮ ਹੀ ਬਣਵਾ ਲਈਏ ਫਿਰ ਪੂਰਾ ਕਮਰੇ ਦੇ ਵਿੱਚ ਸੈਟ ਬੈਡ ਹਾਂ ਪਹਿਲੇ ਤਾਂ ਇਵੇਂ ਸੋਚਿਆ ਸੀ ਖਾਲੀ ਬੈਡ ਬੈੱਡ ਬਣਾ ਲਈਏ ਫਿਰ ਸੋਚਿਆ ਕਿ ਚਲੋ ਜਦੋਂ ਸਮਾਨ ਬਣੀ ਜਾਂਦਾ ਤਾਂ ਫਿਰ ਪੂਰੇ ਕਮਰੇ ਦਾ ਪੂਰਾ ਹੀ ਸੈਟ ਹੀ ਬਣਵਾ ਲਈਏ ਚਲੋ ਅਤੇ ਹਾਂਜੀ ਅਤੇ ਆਪਣੇ ਕਰਦੇ ਕਰਾਉਂਦੇ ਹੁਣ ਫਿਰ ਕਿੰਨਾ ਕੁ ਖਰਚਾ ਆ ਜਾਣਾ ਹੈ

ਉਹਨਾਂ 'ਚ ਅਤੇ ਫਿਰ ਹਾਂਜੀ ਉਹ ਤਸੱਲੀ ਨਹੀਂ ਹੁੰਦੀ ਤੇ ਆਹ ਫਿਰ ਆ ਜਿੰਨੇ ਜਿੰਨੇ ਤੁਸੀਂ ਹੁਣ ਜਿਵੇਂ ਪੈਸੇ ਦੱਸੇ ਹੈ ਅਤੇ ਬਣਵਾਈ ਬਣਵੂਈ ਤੁਹਾਡੀ ਵਿੱਚ ਆਏਗੀ ਕਿ ਜਿਵੇਂ ਅਲੱਗ ਹੋਏਗੀ ਕੋਈ ਸਿਸਟਮ ਇਕੱਲੇ ਕਰੋਗੇ ਕਿ ਤੁਹਾਨੂੰ ਹੋਰ ਵੀ ਚਾਹੀਦੇ ਹੋਣਗੇ ਬੰਦੇ ਨਾਲ ਅੱਛਾ ਜੀ ਅੱਛਾ ਜੀ ਉਹ ਉਹ ਜਿਵੇਂ ਮੈਂ ਤੁਹਾਨੂੰ ਜਿੰਨੇ ਦੇਣੇ ਉਹ ਤੁਸੀਂ ਆਪ ਦੇ ਵਿੱਚ ਉਹਦੇ ਵਿੱਚ ਕਰੋਗੇ ਹੈ ਨਾ ਉਹ ਸਾਡੇ ਵੱਲ ਕੋਈ ਐਕਸਟਰਾ ਖਰਚਾ ਨਹੀਂ ਹੈਗਾ ਅੱਛਾ ਅੱਛਾ ਨਹੀਂ ਚਲੋ ਫਿਰ ਠੀਕ ਹੈ ਆ ਫਿਰ ਆ ਹੁਣ ਆਪਾਂ ਮੈਂ ਜਾਣਾ ਜੀ ਪਰਸੋਂ ਜਾਣਾ ਮੈਂ ਦਾ ਉਹ ਲਕੜੀ ਲੁੱਕੜੀ ਦਾ ਸਮਾਨ ਚੈੱਕ ਕਰਨ ਤਾਂ ਤੁਸੀਂ ਮੇਰੇ ਨਾਲ ਹੀ ਚਲਦੇ ਰਿਹੋ ਤੋ ਆਪਾਂ ਚਲਦੇ ਹਾਂ ਅਤੇ ਵੇਖ ਹੀ ਆਉਂਦੇ ਹਾਂ ਤਾਂ ਫਿਰ ਤੁਸੀਂ ਬਣਾਉਣਾ ਸ਼ੁਰੂ ਕਰੋ ਉਹਨੂੰ ਠੀਕ ਹੈ ਅਤੇ ਉਹ ਹਾਂਜੀ ਹਾਂਜੀ ਉਹ ਮੈਂ ਜਦੋਂ ਜਾਊਂਗਾ ਤਾਂ ਮੈਂ ਤੁਹਾਨੂੰ ਕਾਲ ਕਰ ਦੂੰਗਾ ਜੇ ਤੁਸੀਂ ਆ ਜਾਇਓ ਉੱਥੇ ਠੀਕ ਹੈ ਜੀ ਠੀਕ ਠੀਕ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਠੀਕ